ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਛਾ ਅੱਛਾ ਠੀਕ ਹੈ ਹਾਂਜੀ ਸਰ ਤੁਸੀਂ ਆਏ ਨਹੀਂ ਕੱਲ੍ਹ ਪੀ ਟੀ ਐੱਮ 'ਤੇ ਯੂ ਟੀ ਵਨ ਦੀ ਪੀ ਟੀ ਐੱਮ ਸੀ ਕੱਲ੍ਹ ਠੀਕ ਹੈ ਓਕੇ ਰਿਜਲਟ ਦੇਖਿਆ ਤੁਸੀਂ ਮੈਂ ਅਪਲੋਡ ਕਰ ਦਿੱਤਾ ਅਤੇ ਤੁਹਾਨੂੰ ਮੈਸੇਜ ਕਰਤਾ ਸੀ ਹਾਂਜੀ ਪਹਿਲਾਂ ਨਾਲੋਂ ਵੀ ਪ੍ਰੋਗਰੈਸ ਡਾਊਨ ਜਾ ਰਹੀ ਹੈ ਕਾਫੀ

ਤੁਸੀਂ ਚੈੱਕ ਨਹੀਂ ਕਰਦੇ ਟਿਊਸ਼ਨ 'ਤੇ ਕੀ ਕਰਕੇ ਆਉਂਦਾ ਹਾਂਜੀ ਹਾਂ ਬਟ ਕਲਾਸ 'ਚ ਵੀ ਹੁਣ ਕਾਫੀ ਨੋਟੀ ਹੋ ਗਿਆ ਕਾਫੀ ਸ਼ਰਾਰਤੀ ਬਹੁਤ ਗੱਲਾਂ ਕਰਦਾ ਕੋਈ ਗੱਲ ਨਹੀਂ ਮੰਨਦਾ ਹੋਮ ਵਰਕ ਵੀ ਨਹੀਂ ਕੰਪਲੀਟ ਕਰਦਾ ਮਤਲਬ ਬਹੁਤ ਲਾਪਰਵਾਹ ਹੁੰਦਾ ਜਾ ਰਿਹਾ ਇਸੇ ਕਰਕੇ ਇਹਦੀ ਪ੍ਰੋਗਰੈਸ ਡਾਊਨ ਜਾ ਰਹੀ ਹੈ ਮੈਂ ਤਾਂ ਕਾਫੀ ਸਟਿੱਕਨੈਸ ਸਟਾਰਟ ਕੀਤੀ ਹੈ ਤੁਸੀਂ ਘਰ ਸਟਿੱਕਨੈਸ ਥੋੜ੍ਹੀ ਇਹਦੇ ਨਾਲ ਕਰੋ ਥੋੜ੍ਹਾ ਸਟਿੱਕਟ ਹੋਵੋ ਇਹਦੇ ਨਾਲ ਅਤੇ ਸੋ ਦੈਟ ਇਹਨੂੰ ਵੀ ਪਤਾ ਲੱਗੇ ਕਿ ਕੰਮ ਕਰਨਾ ਹਾਂਜੀ ਤੁਸੀਂ ਵੀ ਸਟਿੱਕਟ ਹੋਵੋ ਬਾਕੀ ਅਸੀਂ ਐਕਸਟਰਾ ਕਲਾਸਿਸ ਲਗਵਾਉਂਦੇ ਹਾਂ ਇਹਨਾਂ ਦੀ ਹਾਂਜੀ ਹਾਂਜੀ ਠੀਕ ਹੈ ਜ਼ਰੂਰ ਠੀਕ ਹੈ ਓਕੇ